ਹੈਲੋ ਹਾਂਜੀ ਹਰਪ੍ਰੀਤ ਮੈਡਮ ਜੀ ਕੀ ਹਾਲ ਹੈ ਜੀ ਹਾਂਜੀ ਵਧੀਆ ਠੀਕ ਹੈ ਜੀ ਠੀਕ ਹੈ ਤੁਹਾਡਾ ਸਕੂਲ ਦਾ ਕਿਵੇਂ ਚੱਲ ਰਿਹਾ ਜੀ ਹਾਂਜੀ ਅਸੀਂ ਵੀ ਅੱਜ ਕਾਫੀ ਦਿਨਾਂ ਪਿੱਛੋਂ ਗਏ ਤਾਂ ਐਂ ਲੱਗਦਾ ਵੀ ਸਾਰੀ ਦੁਨੀਆਂ ਸੜਕ 'ਤੇ ਤੁਰੀ ਫਿਰਦੀ ਹੈ ਹਾਂਜੀ ਬਿਲਕੁਲ ਬਿਲਕੁਲ ਕਾਰ 'ਚ ਵੀ ਇਹ ਦੇਖੋ ਵੀ ਇੱਕ ਬੰਦਾ ਹੀ ਜਾਂਦਾ ਹੁੰਦਾ ਬੈਠਾ ਜੀ ਕੋਈ ਇਹ ਵੀ ਨਹੀਂ ਵੀ ਫੈਮਿਲੀ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਚਲ ਜਾਣ ਆਉਣ ਦਾ ਵੀ ਕੋਈ ਚੱਕਰ ਨਹੀਂ ਜੀ ਸਾਰੇ ਜਿੰਨੇ ਜੇ ਡਰਾਈਵਿੰਗ ਸਹੀ ਹੋਵੇ ਫਿਰ ਤਾਂ ਸਾਰਾ ਠੀਕ ਚੱਲ ਸਕਦਾ ਏ ਡਰਾਈਵਿੰਗ ਵੀ ਆਪਣੇ ਹਾਂ ਜਾਂਦੇ ਇਹ ਨਹੀਂ ਪਤਾ ਕਿੱਥੋਂ ਯੂ ਟਰਨ ਲੈ ਲੈਂਦੇ ਨੇ ਪਤਾ ਹੀ ਨਹੀਂ ਲੱਗਦਾ ਹਾਂਜੀ ਮੇਨ ਤਾਂ ਰੂਲ ਹੈ ਵੀ ਥੋੜ੍ਹਾ ਜਿਹਾ ਸਟ੍ਰਿਕਲੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹਾ ਬਿਲਕੁਲ ਬਿਲਕੁਲ ਜੀ ਨਹੀਂ ਹੁਣ ਇਹ ਤਾਂ ਬੜਾ ਮੁਸ਼ਕਿਲ ਲੱਗਦਾ ਹੈਗਾ ਵੀ ਅੱਗੇ ਅੱਗੇ ਪਹਿ ਇਸ ਤੋਂ ਦੇਖੋ ਤੁਸੀਂ ਅੱਠ ਦਸ ਸਾਲ ਪਹਿਲਾਂ ਇੰਨੀ ਟਰੈਫਿਕ ਨਹੀਂ ਸੀ ਹਾਂ ਜੀ ਥੋੜ੍ਹਾ ਪ੍ਰਸ਼ਾਸਨ ਨੂੰ ਵੀ ਸਖਤਾਈ ਚਾਹੀਦੀ ਹੈ ਜੀ ਕਰਨੀ ਹਾਂ ਹਾਂ ਕਿਉਂਕਿ ਜੇ ਪ੍ਰਸ਼ਾਸਨ ਸੜਕ 'ਤੇ ਹੋਵੇਗਾ ਤਾਂ ਰੂਲ ਸਭ ਦੇ ਨਾਲ ਦੀ ਨਾਲ ਦੇਖ ਕੇ ਫੋਲੋ ਕਰਨ ਲੱਗ ਜਾਂਦੇ ਨੇ ਨਹੀਂ ਕੋਈ ਨਹੀਂ ਫੋਲੋ ਕਰਦਾ ਫਿਰ ਸਭ ਯਾਦ ਆ ਜਾਂਦਾ ਵੀ ਕਿੱਥੇ ਕੀ ਕਰਨਾ

ਹਾਂਜੀ ਹਾਂਜੀ ਹਾ ਬਿਲਕੁਲ ਬਿਲਕੁਲ ਚਲੋ ਮਾਰਿਓ ਚੱਕਰ ਕਿਸੇ ਦਿਨ ਜੀ ਹਾਂਜੀ ਠੀਕ ਠੀਕ ਹੈ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ